ਹੈਲੋ ਹਾਂਜੀ ਮੈਨੂੰ ਨਾ ਮੈਂ ਤੁਹਾਡੇ ਨਾਲ ਜੀ ਇੱਕ ਗੱਲ ਕਰਨੀ ਸੀਗੀ ਅਸੀਂ ਨਾ ਜੀ ਰਾਜਸਥਾਨ ਜਾਣਾ ਟੂਰ 'ਤੇ ਅਤੇ ਮੈਨੂੰ ਤੁਹਾਡੇ ਨਾ ਮੇਰੇ ਦੋਸਤ ਤੋਂ ਨੰਬਰ ਮਿਲਿਆ ਸੀ ਤੁਹਾਡਾ ਹਾਂਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਬਈ ਉੱਥੇ ਕੋਈ ਖਾਣੇ ਬਾਰੇ ਕੋਈ ਖਾਸ ਸਪੈਸ਼ਲ ਉਹਨਾਂ ਦੀ ਚੀਜ਼ ਜਿਹੜੀ ਬਈ ਮਤਲਬ ਕਿ ਅਸੀਂ ਜਾ ਕੇ ਉੱਥੇ ਟਰਾਈ ਕਰ ਸਕੀਏ ਹਾਂਜੀ ਅੱਛਾ ਜੀ

ਹਾਂਜੀ ਅੱਛਾ ਜੀ ਅੱਛਾ

ਅੱਛਾ ਜੀ ਅੱਛਾ ਹਾਂਜੀ ਹਾਂ ਮਤਲਬ ਕਿ ਆਪਾਂ ਘਰ ਲਈ ਲੈ ਕੇ ਆ ਸਕਦੇ ਆ ਖਰੀਦ ਕੇ ਹਾਂਜੀ ਹਾਂ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਅੱਛਾ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਅੱਛਾ ਯਾਨੀ ਕਿ ਅਸੀਂ ਉਹ ਟਰਾਈ ਕਰ ਸਕਦੇ ਆ ਕੇ ਹਾਂਜੀ ਹਾਂਜੀ ਹਾਂ ਅੱਛਾ ਵਧੀਆ ਠੀਕ ਹੈ ਜੀ ਦੇਸੀ ਦੇਸੀ ਘਿਓ ਪਾ ਕੇ ਕੋਈ ਮਿਲਾਵਟ ਤਾਂ ਨਹੀਂ ਹੁੰਦੀ ਹੋਣੀ ਅੱਛਾ ਅੱਛਾ ਅੱਛਾ

ਠੀਕ ਹੈ ਜੀ ਠੀਕ ਹੈ ਅੱਛਾ ਜੀ ਹਾਂਜੀ ਹਾਂਜੀ ਹਾਂ ਹਾਂ ਹਾਂ ਇੱਕ ਉੱਧਰ ਨੇੜੇ ਬੀਕਾਨੇਰ ਉੱਧਰ ਭੁਜੀਆਂ ਭਾਜੀਆਂ ਵੀ ਵਧੀਆ ਮਿਲਦਾ ਹੋਵੇਗਾ ਜੀ ਅੱਛਾ ਅੱਛਾ ਅੱਛਾ ਜੀ ਅੱਛਾ ਹਾਂਜੀ ਅੱਛਾ ਅੱਛਾ ਅੱਛਾ ਜੀ

ਹਾਂਜੀ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਅੱਛਾ ਜੀ ਅੱਛਾ ਅੱਛਾ ਠੀਕ ਹੈ ਜੀ ਹਾਂਜੀ ਹਾਂ ਹਾਂਜੀ ਅੱਛਾ ਜੀ

ਠੀਕ ਹੈ ਜੀ ਠੀਕ ਹੈ ਠੀਕ ਹੈ ਵਧੀਆ ਜੀ ਵਧੀਆ ਵਧੀਆ ਮੈਂ ਤਾਂ ਐ ਮੈਨੂੰ ਮੈਨੂੰ ਤੁਹਾਡਾ ਨੰਬਰ ਮਿਲਿਆ ਸੀ ਆਪਣੇ ਦੋਸਤ ਕੋਲੋਂ ਮੈਂ ਕਿਹਾ ਚਲੋ ਇੱਕ ਵਾਰੀ ਪੁੱਛਦੇ ਆ ਉਹਨਾਂ ਨੂੰ ਹਾਂਜੀ ਹਾਂਜੀ ਹਾਂ ਅੱਛਾ ਅੱਛਾ ਜੀ ਅੱਛਾ

ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਚਲੋ ਉੱਥੇ ਜਾ ਕੇ ਤੁਹਾਨੂੰ ਕੋਲ ਕਰ ਲਵਾਂਗੇ ਜੀ ਦੁਆਰੇ ਪੁੱਛ ਲਵਾਂਗੇ ਠੀਕ ਹੈ ਜੀ ਓਕੇ ਜੀ